ਮੈਨੂੰ ਕੁਕਿੰਗ ਕਰਨਾ ਬਹੁਤ ਹੀ ਪਸੰਦ ਹੈ ਮੈਂ ਛੋਟੀ ਹੁੰਦੀ ਤੋਂ ਹੀ ਕੁਕਿੰਗ ਕਰਦੀ ਆਈ ਹਾਂ ਮੇਰੇ ਘਰਦਿਆਂ ਨੂੰ ਮੇਰੇ ਹੱਥ ਦਾ ਖਾਣਾ ਬਹੁਤ ਹੀ ਪਸੰਦ ਆਉਂਦਾ ਹੈ ਮੇਰੇ ਮੰਮੀ ਡੈਡੀ ਦਾਦਾ ਦਾਦੀ ਭੈਣ ਭਰਾ ਨੂੰ ਬਹੁਤ ਹੀ ਖਾਣਾ ਪਸੰਦ ਹੈ ਸ਼ਾਮ ਸਵੇਰੇ ਸ਼ਾਮ ਨੂੰ ਮੈਂ ਹੀ ਖਾਣਾ ਬਣਾਉਂਦੀ ਹਾਂ ਜਦ ਵੀ ਮੈਂ ਸੈਂਟਰ ਜਾਂਦੀ ਹਾਂ ਤਾਂ ਖਾਣ ਉੱਥੇ ਲੈ ਕੇ ਜਾਂਦੀ ਹਾਂ ਹੁਣ ਤਿਉਹਾਰ ਵਾਲੇ ਦਿਨ ਮੈਂ ਕਚੋਰੀਆਂ ਬਣਾਈਆਂ ਸੀ ਮੈਂ ਕਚੋਰੀਆਂ ਸੈਂਟਰ ਵੀ ਲੈ ਗਈ ਸੀ ਉੱਥੇ ਦੇ ਮੇਰੀ ਸਹੇਲੀਆਂ ਅਤੇ ਮੇਰੀ ਮੈਡਮਾਂ ਨੇ ਬਹੁਤ ਹੀ ਸਿਫਤ ਕੀਤੀ ਕਿ ਤੂੰ ਖਾਣਾ ਬਹੁਤ ਹੀ ਵਧੀਆ ਬਣਾਉਂਦੀ ਹਾਂ ਮੈਨੂੰ ਮੈਨੂੰ ਵੀ ਲੱਗਦਾ ਹੈ ਕਿ ਮੈਂ ਬਹੁਤ ਹੀ ਖਾਣਾ ਵਧੀਆ ਬਣਾਉਂਦੀ ਹਾਂ ਮੇਰੇ ਰਿਸ਼ਤੇਦਾਰ ਵੀ ਬਹੁਤ ਹੀ ਸਿਫਤਾਂ ਕਰਦੇ ਹਨ ਕਿ ਤੂੰ ਖਾਣਾ ਬਹੁਤ ਹੀ ਵਧੀਆ ਬਣਾਉਂਦੀ ਹੈ ਤਾਂ ਮੈਨੂੰ ਵੀ ਲੱਗਦਾ ਹੈ ਕਿ ਮੈਂ ਖਾਣਾ ਬਹੁਤ ਹੀ ਵਧੀਆ ਬਣਾਉਂਦੀ ਹਾਂ